ਹਾਂਜੀ ਠੀਕ ਆ ਬੱਚਾ ਕਿੰਨੇ ਸਾਲਾਂ ਦਾ ਆ ਠੀਕ ਆ ਕਰ ਕਰਵਾ ਦੇਵਾਂਗੇ ਕੋਈ ਨਹੀਂ ਤੁਸੀਂ ਲੈ ਆਇਓ ਛੇ ਛੇ ਸਾਲ ਦਾ ਬੱਚਾ ਅਸੀਂ ਲੈ ਲੈਂਦੇ ਹਾਂ ਠੀਕ ਹੈ ਬੱਚੇ ਨੂੰ ਬੱਚੇ ਦੀ ਬਾਕੀ ਪੜ੍ਹਾਈ ਵੀ ਚੱਲੂਗੀ ਨਾਲ ਹੀ ਅਤੇ ਪਾਠ ਸਿਖਾਇਆ ਜਾਵੇਗਾ ਜਪੁਜੀ ਸਾਹਿਬ ਦਾ ਕਰਨਾ ਪਹਿਲਾਂ ਨਿਤਨੇਮ ਕਰਨ ਦਾ ਬਸ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਉਦੋਂ ਕਲਾਸਾਂ ਵੱਧਦੀਆਂ ਜਾਣਗੀਆਂ ਉਵੇਂ ਉਵੇਂ ਮਤਲਬ ਕਿ ਇਹਨੂੰ ਸਿਖਲਾਈ ਸਾਰੀ ਦਿੱਤੀ ਜਾਵੇਗੀ ਗੱਤਕੇ ਦੀ ਕੀਰਤਨ ਕਰਨ ਦੀ ਤਬ ਤਬਲਾ ਤਬਲਾ ਸਿਖਾਉਣਾ ਕਥਾ ਵਾਚ ਕਥਾ ਦਾ ਵੀ ਦੱਸਣਾ ਵੀ ਕਥਾਵਾਚਕ ਬਣਨਾ ਅਤੇ ਸਹਿਜ ਪਾਠ ਕਰਨਾ ਹਾਂ ਹਾਂ ਹਰਮੋਨੀਆ ਵੀ ਸਿਖਾਇਆ ਜਾਵੇਗਾ ਸਾਰਾ ਕੀਰਤਨ ਕਰਨ ਸਿਖਾਇਆ ਜਾਂਦਾ ਅਤੇ ਫੀਸ ਵਗੈਰਾ ਆਪਣੀ ਜ਼ਾਇਜ ਹੀ ਆ ਬਾਕੀ ਮਤਲਬ ਜੇ ਤਾਂ ਕੋਈ ਭਰ ਸਕਦਾ ਤਾਂ ਠੀਕ ਆ ਜੇ ਕੋਈ ਨਹੀਂ ਵੀ ਭਰ ਸਕਦਾ ਤਾਂ ਅਸੀਂ ਅਗਲੇ ਦੀ ਬੱਚੇ ਦੀ ਮਦਦ ਵੀ ਕਰਦੇ ਹਾਂ ਅਸੀਂ ਅੱਧੀ ਫੀਸ ਲੈ ਲਈ ਕਿਸੇ ਕੋਲੋਂ ਕਿਸੇ ਕੋਲ ਕਿਸੇ ਨੂੰ ਬਿਲਕੁਲ ਫਰੀ ਵੀ ਛੱਡ ਦੇਈ ਦਾ ਜਿਹੜਾ ਬਿਲਕੁਲ ਭਰ ਭਰ ਨਹੀਂ ਸਕਦਾ ਫੀਸ

ਇਸ ਤੋਂ ਇਲਾਵਾ ਬਸ ਇਹ ਹੀ ਮਤਲਬ ਸਾਰੀਆਂ ਸਿਖਲਾਈਆਂ ਦਿੱਤੀਆਂ ਜਾਂਦੀਆਂ ਬੱਚਿਆਂ ਨੂੰ ਬਾਕੀ ਰਹਿਣ ਦਾ ਇੰਤਜ਼ਾਮ ਇੱਥੇ ਬਹੁਤ ਵਧੀਆ ਆ ਕਮਰੇ ਹੈਗੇ ਆ ਸਕੂਲ ਆ ਸਾਰਾ ਰੋਟੀ ਪਾਣੀ ਦਾ ਸਾਰਾ ਇੱਥੇ ਰੇਜਮੈਂਟ ਆ ਬੱਚੇ ਦੀ ਰਿਹਾਇਸ਼ ਵੀ ਅਤੇ ਰਹਿਣਾ ਵੀ ਫ੍ਰੀ ਆ ਇੱਥੇ ਨਹੀਂ ਬਸ ਹੋਰ ਕੋਈ ਖਰਚਾ ਨਹੀਂ ਬਾਕੀ ਕੱਪੜਾ ਲੀੜਾ ਧੋਤਾ ਦਿੱਤਾ ਹੋਇਆ ਬੱਚੇ ਨੂੰ ਯੂਨੀਫੋਰਮ ਵਗੈਰਾ ਉਹ ਕ ਜਿਹੜੀਆਂ ਮਾਈਆਂ ਰੱਖੀਆਂ ਹੋਈਆਂ ਉਹ ਧੋਤੇ ਹੋਏ ਕੱਪੜੇ ਦੇ ਦਿਆ ਕਰਨ ਗੀਆਂ ਜੇ ਬੱਚੇ ਨੇ ਇੱਥੇ ਰਹਿਣਾ ਤਾਂ ਜੇ ਤੁਸੀਂ ਛੱਡ ਜਾਂਦੇ ਹੋ ਅਤੇ ਲੈ ਜਾਂਦੇ ਹੋ ਉਹ ਤੁਹਾਡੇ ਮਰਜੀ ਆ ਜੇ ਤਾਂ ਤੁਸੀਂ ਲੋਕਲ ਆ ਤਾਂ ਫਿਰ ਤਾਂ ਬੱਚਾ ਅਪ ਡਾਊਨ ਕਰ ਸਕਦਾ ਅਤੇ ਜੇ ਮਤਲਬ ਕਿ ਜੇ ਦੂਰੋਂ ਮਤਲਬ ਬੱਚੇ ਦੇ ਰਹਿਣ ਵਾਸਤੇ ਵੀ ਹੈਗਾ ਇੱਥੇ ਇੰਤਜ਼ਾਮ ਤੁਸੀਂ ਜਦੋਂ ਮਰਜ਼ੀ ਆ ਜਾਣਾ ਆਹ ਦੋ ਦਿਨ ਛੁੱਟੀਆਂ ਹੈਗੀਆਂ ਦੀਵਾਲੀ ਦੀਆਂ ਇਹ ਇਹ ਛੁੱਟੀਆਂ ਦੇ ਦਿਨ ਲੰਘ ਜਾਣਗੇ ਤਾਂ ਫਿਰ ਤੁਸੀਂ ਲੈ ਆਉਣਾ ਬੱਚੇ ਨੂੰ ਬਸ ਆਹ ਨੌਂ ਵਜੇ ਤੋਂ ਲੈ ਕੇ ਟੈਮ ਸਕੂਲ ਸਕੂਲਾਂ ਦਾ ਟੈਮ ਨੌਂ ਵਜੇ ਤੋਂ ਲੈ ਕੇ ਅਤੇ ਤਿੰਨ ਤਿੰਨ ਵਜੇ ਤੱਕ ਹਾਂ ਹਾਂ ਹਾਂ ਹਾਂ ਕੋਈ ਗੱਲ ਨਹੀਂ ਆ ਜਾਇਓ ਤੁਸੀਂ ਹਾਂਜੀ ਠੀਕ ਹੈ ਠੀਕ ਹੈ ਜੀ ਜੀ ਆਇਆਂ ਨੂੰ ਕੋਈ ਨਹੀਂ ਠੀਕ ਸਤਿ ਸ਼੍ਰੀ ਅਕਾਲ